ਭਾਰਤ ਵੱਖ ਵੱਖ ਰਾਜਾਂ ਦਾ ਦੇਸ਼ ਆ ਅਤੇ ਉਸੇ ਤਰੀਕੇ ਨਾਲ ਦਾ ਵੱਖ ਵੱਖ ਰਾਜਾਂ ਦਾ ਆਪਣਾ ਇੱਕ ਪਹਿਰਾਵਾ ਹੈ ਆਪਣਾ ਇੱਕ ਕਲਚਰ ਹੈ ਉਸੇ ਤਰੀਕੇ ਨਾਲ ਜਿਵੇਂ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਤਾਂ ਸਾਡਾ ਵੀ ਇੱਕ ਵੱਖਰਾ ਕਲਚਰ ਆ ਵੱਖਰਾ ਪਹਿਰਾਵਾ ਹੈ ਜਿਵੇਂ ਆਪਾਂ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਸਲਵਾਰ ਸੂਟ ਫੁਲਕਾਰੀ ਪਿੱਪਲ ਪੱਤੀਆਂ ਕੰਨਾਂ ਦੇ ਵਿੱਚ ਅਤੇ ਸੱਗੀ ਫੁੱਲ ਇਹ ਸਾਡਾ ਕੁੜੀਆਂ ਦਾ ਪਹਿਰਾਵਾ ਪੰਜਾਬ ਦੇ ਵਿੱਚ ਜਿਹਦੇ ਨਾਲ ਉਹ ਵੱਖਰੀਆਂ ਦਿਖਦੀਆਂ ਨੇ ਸਾਰ ਸਾਰੇ ਕੰਟਰੀ ਤੋਂ ਸਾਰੇ ਰਾਜਾਂ ਤੋਂ ਉਸੇ ਤਰੀਕੇ ਨਾਲ ਜੇ ਆਪਾਂ ਮੁੰਡਿਆਂ ਦੀ ਗੱਲ ਕਰੀਏ ਤਾਂ ਉਹ ਕੁੜਤਾ ਪਜਾਮਾ ਪਾਉਣਾ ਅਤੇ ਪੱਗ ਬੰਨਣਾ ਹੈ ਨਾ ਕੈਂਠਾ ਪਾਉਣਾ ਤਾਂ ਉਹ ਮੁੰਡਿਆਂ ਦਾ ਪਹਿਰਾਵਾ ਹੈ ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਜਿਹੜਾ ਹੈ ਕੁੜਤਾ ਪਜਾਮਾ ਜਾਂ ਫਿਰ ਚਾਦਰਾ ਪਾਉਣਾ ਜ਼ਿਆਦਾ ਪ੍ਰੈਫਰ ਕਰਦੇ ਨੇ ਇਹ ਪਹਿਰਾਵਾ ਸਾਨੂੰ ਸਾਰੇ ਮਤਲਬ ਵੱਖ ਵੱਖ ਰਾਜਾਂ ਤੋਂ ਸਾਨੂੰ ਅਲੱਗ ਦਿੱਖ ਪ੍ਰੋਵਾਈਡ ਕਰਵਾਉਂਦਾ ਹੈ